ਸਰਕਾਰ ਛੋਟੇ ਕਾਰੋਬਾਰੀਆਂ ਨੂੰ ਮਾਰਕੀਟਿੰਗ ਬਾਰੇ ਸਮਝਾਉਂਦੇ ਹਾਂ ਬਹੁਤ ਸਾਰੇ ਈਵੈਂਟ ਕੈਂਪ ਲਗਾਉਂਦੀ ਹੈ ਜਿਸ ਦੇ ਨਾਲ ਉਨ੍ਹਾ ਨੂੰ ਮਾਰਕੀਟਿੰਗ ਬਾਰੇ ਨੋਲੇਜ਼ ਹੋ ਸਕੇ ਅਤੇ ਉਨਾਂ ਨੂੰ ਪਤਾ ਲੱਗ ਜਾਵੇ ਕਿ ਮਾਰਕਿਟ ਵਿੱਚ ਕਿਵੇਂ ਅਤੇ ਕਿਸ ਤਰ੍ਹਾਂ ਦਾ ਕੰਮ ਕਰਨਾ ਹੁੰਦਾ ਹੈ ਸਰਕਾਰ ਆਪਣੇ ਕਾਰੋਬਾਰੀਆਂ ਨੂੰ ਥੋੜ੍ਹੇ ਥੋੜ੍ਹੇ ਪੈਸੇ ਵਿਆਜ ਵਿੱਚ ਦੇ ਦਿੰਦੀ ਹੈ ਅਤੇ ਕਹਿੰਦੀ ਹੈ ਕਿ ਜਦ ਉਨ੍ਹਾਂ ਦਾ ਕੰਮ ਚੰਗਾ ਚੱਲ ਪਵੇ ਤਾਂ ਉਹ ਉਸਨੂੰ ਮੋੜ ਦੇਣ ਥੋੜ੍ਹੇ ਥੋੋੜ੍ਹੇ ਪੈਸੇ ਕਰਕੇ ਅਤੇ ਇਸਦੇ ਨਾਲ ਕਾਰੋਬਾਰੀਆਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ ਅਤੇ ਇਸਦੇ ਕਾਰਨ ਪੰਜਾਬ ਵਿੱਚ ਅਤੇ ਭਾਰਤ ਵਿੱਚ ਬੇਰੁਜ਼ਗਾਰੀ ਵੀ ਘੱਟ ਰਹੀ ਹੈ ਕਿਉਂਕਿ ਲੋੜਵੰਦਾਂ ਨੂੰ ਆਪਣੀ ਲੋੜ ਅਨੁਸਾਰ ਕੰਮ ਮਿਲ ਰਿਹਾ ਹੈ ਅਤੇ ਉਹ ਕੰਮ ਕਰਕੇ ਆਪਣਾ ਭੋਜਨ ਜਿੰਨਾਂ ਕਮਾ ਲੈਂਦੇ ਹਨ ਤਾਂ ਕਿ ਉਨ੍ਹਾਂ ਦਾ ਭੋਜਨ ਜਿੰਨਾਂ ਖਰਚਾ ਨਿਕਲ ਜਾਵੇ ਅਤੇ ਉਹ ਕੁਝ ਪੈਸੇ ਬਚੇ ਹੋਏ ਆਪਣੇ ਪਰਿਵਾਰਾਂ ਨੂੰ ਵੀ ਭੇਜ ਦਿੰਦੇ ਹਨ ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਵੀ ਭੁੱਖੇ ਨਹੀਂ ਰਹਿੰਦੇ